ਕੰਮ ਤੋਂ ਬਾਹਰ ਮੇਰਾ ਸ਼ੌਕ ਇਹ ਸੀ ਕਿ ਮੈਂ ਜਿੰਨੇ ਵੀ ਗਰੀਬ ਬੱਚੇ ਸੀ ਆਪਣੀ ਕਲੋਨੀ ਦੇ ਵਿੱਚ ਉਹਨਾਂ ਨੂੰ ਮੁਫ਼ਤ ਪੜ੍ਹਾਇਆ ਅਤੇ ਪੜ੍ਹਾਉਣ ਦੇ ਨਾਲ ਨਾਲ ਉਹਨਾਂ ਨੂੰ ਖੇਡਾਂ ਵਿੱਚ ਵੀ ਦਿਲਚਸਪੀ ਕਿਆ ਹੈ ਦਿਖਾਈ ਇਸਦੇ ਨਾਲ ਕਲੋਨੀ ਦੀ ਜੇ ਸਫ਼ਾਈ ਹੈ ਉਹਦੇ ਵਿੱਚ ਵੀ ਬੜਾ ਮੈਂ ਯੋਗਦਾਨ ਪਾਇਆ ਆਪਣੇ ਕੋਲ਼ੋਂ ਕੁਝ ਪੈਸੇ ਦੇ ਕੇ ਵੀ ਮਜ਼ਦੂਰ ਤੋਂ ਕੂੜਾ ਕਰਕਟ ਚੁਕਵਾਇਆ ਤਾਂ ਕਿ ਕਲੋਨੀ ਦੇ ਵਿੱਚ ਕੋਈ ਇਹੋ ਜਿਹੀ ਬਿਮਾਰੀ ਨਾ ਫੈਲੇ ਜਿਹਦੇ ਨਾਲ ਕਿ ਕਲੋਨੀ ਨੂੰ ਨੁਕਸਾਨ ਪਹੁੰਚੇ ਮੇਰੀਆਂ ਦਿਲਚਸਪੀਆਂ ਆਮ ਤੌਰ 'ਤੇ ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾਉਣਾ ਅਤੇ ਉਸ ਤੋਂ ਬਾਅਦ ਸਿਹਤਮੰਦ ਰਹਿਣ ਦੇ ਲਈ ਯੋਗਾ ਆਸਨ ਕਰਵਾਉਣਾ ਅਤੇ ਸ਼ਾਮ ਸਵੇਰ ਦੀ ਸੈਰ ਕਰਨੀ ਸੈਰ ਦੇ ਨਾਲ ਇਹ ਹੋਇਆ ਕਿ ਮੇਰਾ ਸਿਹਤਮੰਦੋ ਮੈਂ ਬਿਲਕੁਲ ਤੰਦਰੁਸਤ ਹਾਂ